ਸਮਾਂ ਤਾਂ ਅੱਜ ਕੱਲ੍ਹ ਸਮੇਂ ਸਮੇਂ ਦੀ ਗੱਲ ਹੈ ਸਮਾਂ ਵਿਆਹ ਸ਼ਾਦੀਆਂ 'ਚ ਬਿਤਾਇਆ ਜਾਂਦਾ ਵਾ ਅਤੇ ਵਿਆਹ ਸ਼ਾਦੀਆਂ ਵਿੱਚ ਹੀ ਰਸੋਈ ਵੀ ਸਾਂਝੀ ਕੀਤੀ ਜਾਂਦੀ ਆ ਲੋਕ ਦਸ ਦਸ ਦਸ ਦਿਨ ਇੱਕੇ ਘਰ 'ਚ ਰੋਟੀ ਹੁੰਦੀ ਆ ਸਾਰੇ ਪਰਿਵਾਰ ਮੈਂਬਰ ਸਾਰੇ ਇਕੱਠੇ ਹੋਏ ਹੁੰਦੇ ਆ ਵਿਚਾਰਾਂ ਕਰੀਦੀਆਂ ਸਾਂਝੀਆਂ ਇੱਕ ਦੂਜੇ ਦੇ ਨਾਲ ਫਿਰ ਹੋਰ ਫਿਰ ਹੋਰ ਪਕਵਾਨ ਸਾਂਝੇ ਕੀਤੇ ਜਾਂਦੇ ਆ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਰੋਟੀ ਪਾਣੀ ਬਣਾਇਆ ਜਾਂਦਾ ਵਾ ਇੱਕੇ ਥਾਂ ਬਹਿ ਕੇ ਖਾਂਦੇ ਆ ਸਾਰੇ ਤਾਂ ਬਹੁਤ ਵਧੀਆ ਲੱਗਦਾ ਜਦੋਂ ਸਾਰਾ ਪਰਿਵਾਰ ਇਕੱਠਾ ਹੋਇਆ ਹੁੰਦਾ ਹੈ ਅਤੇ ਸਾਰੇ ਇੱਕ ਦੂਜੇ ਨਾਲ ਰੋਟੀ ਖਾਂਦੇ ਆ ਅਤੇ ਵੱਖਰੇ ਵੱਖਰੇ ਪਕਵਾਨ ਬਣਾਉਂਦੇ ਆ ਅਤੇ ਸਾਰੇ ਸ਼ਰੀਕਾ ਨੂੰ ਸ਼ਰੀਕਾ ਨੂੰ ਸੱਦਦੇ ਆ ਕੋਈ ਵਿਆਹ ਸ਼ਾਦੀ ਹੁੰਦਾ ਵਾ ਤਾਂ ਬਹੁਤ ਵਿਚਾਰਾਂ ਕਰਦੇ ਇੱਕ ਦੂਜੇ ਦੇ ਨਾਲ ਅਤੇ ਹੋਰ ਬਹੁਤ ਸਾਰੇ ਹੁੰਦੇ ਆ ਫੰਕਸ਼ਨ ਜਿਨ੍ਹਾਂ ਵਿੱਚ ਇੱਕ ਦੂਜੇ ਦੇ ਨਾਲ ਰਸੋਈ ਸਾਂਝੀ ਕੀਤੀ ਜਾਂਦੀ ਆ ਕੋਈ ਨਵੀਂ ਵਹੁਟੀ ਆਉਂਦੀ ਹੈ ਤਾਂ ਉਹਨਾਂ ਦੇ ਉਹਨੂੰ ਚੌਂਕੇ ਚੜਾਇਆ ਜਾਂਦਾ ਆ ਉਹਨਾਂ ਰਸੋਈ ਸਾਂਝੀ ਕਰਦੀ ਆ ਅਤੇ ਇਹ ਕਲਚਰ ਸਾਡੇ ਪੰਜਾਬ ਦਾ ਜਿਹੜਾ ਇੱਕ ਦੂਜੇ ਨਾਲ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨੀਆਂ ਵਿਚਾਰ ਸਾਂਝੇ ਕਰਨੇ ਰਸੋਈ ਨੂੰ ਸਾਂਝਾ ਕਰਨਾ